ਪੰਜਾਬੀ ਸੱਭਿਆਚਾਰ ਦੇ ਵਿੱਚ ਜ਼ਿਆਦਾਤਰ ਇਹ ਮੰਨਿਆ ਜਾਂਦਾ ਕਿ ਜਿਹੜੀ ਪੰਜਾਬੀ ਲੋਕ ਹੁੰਦੇ ਹੈਗੇ ਉਹ ਜਾਂ ਤਾਂ ਬਹੁਤ ਜ਼ਿਆਦਾ ਝਗੜਾਲੂ ਹੁੰਦੇ ਆ ਬਹੁਤ ਜ਼ਿਆਦਾ ਗੁੱਸੇ ਵਾਲੇ ਹੁੰਦੇ ਹਨ ਅਤੇ ਉਹ ਹਰ ਵਕਤ ਅ ਲੜਦੇ ਹੀ ਰਹਿੰਦੇ ਹਨ ਪਰ ਇਹ ਬਹੁਤ ਹੀ ਇੱਕ ਗਲਤ ਜਿਹਾ ਪੱਖ ਹੈਗਾ ਜਿਹੜਾ ਕਿ ਪੰਜਾਬੀਆਂ ਬਾਰੇ ਸੋਚਿਆਂ ਜਾਂਦਾ ਹੈਗਾ ਸਮਝਿਆ ਜਾਂਦਾ ਹੈਗਾ ਲੋਕ ਇਸ ਨੂੰ ਮੰਨਦੇ ਨੇ ਪਰ ਅਜਿਹਾ ਨਹੀਂ ਹੈਗਾ ਕਿ ਪੰਜਾਬੀ ਹਮੇਸ਼ਾ ਹੀ ਲੜਦੇ ਰਹਿੰਦੇ ਆ ਬਹੁਤ ਸਾਰੇ ਅਜਿਹੇ ਵੀ ਹਨ ਜਿਹੜੇ ਕਿ ਬਹੁਤ ਮਦਦ ਕਰਦੇ ਹਨ ਪੰਜਾਬੀ ਜਿਹੜੇ ਦੂਜੇ ਲੋਕਾਂ ਨੂੰ ਆਪਸ ਦੇ ਵਿੱਚ ਮਿਲਵਰਤਣ ਦੇ ਨਾਲ ਰਹਿੰਦੇ ਹਨ ਜਦੋਂ ਕੋਈ ਵੀ ਮੁਸੀਬਤ ਆਉਂਦੀ ਆ ਤਾਂ ਉਦੋਂ ਸਾਰੇ ਮਿਲ ਕੇ ਆਪਸ ਦੇ ਵਿੱਚ ਕੰਮ ਕਰਦੇ ਹਨ ਪਰ ਕੁਝ ਕੁ ਜਿਵੇਂ ਜਿਹੜੇ ਝਗੜਾਲੂ ਸਾਨੂੰ ਇਹ ਚਾਹੀਦਾ ਕਿ ਅਸੀਂ ਇਸ ਨੂੰ ਧਾਰਨਾ ਨੂੰ ਬਦਲੀਏ ਕਿ ਜਿਹੜੇ ਪੰਜਾਬੀ ਉਹ ਗੁੱਸੇ ਵਾਲੇ ਹੁੰਦੇ ਹਨ ਬਹੁਤ ਜ਼ਿਆਦਾ ਸਥਿਤੀਆਂ ਇਹੋ ਜਿਹੀਆਂ ਵੀ ਹੁੰਦੀਆਂ ਨੇ ਜਿੱਥੇ ਬਹੁਤ ਜ਼ਿਆਦਾ ਲੋਕ ਇਕੱਠੇ ਹੋ ਕੇ ਆਪਸ ਦੇ ਵਿੱਚ ਮਿਲ ਕੇ ਕਿਸੇ ਸਥਿਤੀ ਨੂੰ ਉਹਦਾ ਹੱਲ ਕਰਦੇ ਹੈਗੇ ਤਾਂ ਇਹ ਆ ਜਿਹੜੀ ਧਾਰਨਾ ਨੂੰ ਅਸੀਂ ਅ ਠੀਕ ਕਰ ਸਕਦੇ ਹਾਂ ਪੰਜਾਬੀਆਂ ਦੇ ਬਾਰੇ ਜੋ ਵੀ ਇਹਦੇ ਬਾਰੇ ਬਣੀ ਹੋਈ ਹੈ ਦੂਜਾ ਇਹ ਵੀ ਬਣੀ ਹੋਈ ਹੈ ਕਿ ਜਿਹੜੇ ਪੰਜਾਬੀ ਹੈ ਮੁੰਡੇ ਉਹ ਜ਼ਿਆਦਾਤਰ ਬਹੁਤ ਜ਼ਿਆਦਾ ਨਸ਼ੇ ਕਰਦੇ ਆ ਜਾਂ ਪੰਜਾਬੀ ਦੀ ਨੌਜਵਾਨ ਪੀੜ੍ਹੀ ਖ਼ਰਾਬ ਹੋ ਚੁੱਕੀ ਹੈ ਇਹ ਇੱਕ ਪੱਖ ਆ ਪੰਜਾਬੀ ਨੌਜਵਾਨ ਪੀੜ੍ਹੀ ਦਾ ਪਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਜਿਹੜੇ ਸਾਡੇ ਨੌਜਵਾਨ ਇਹੋ ਜਿਹੇ ਵੀ ਆ ਜਿਹੜੇ ਕਿ ਬਹੁਤ ਜ਼ਿਆਦਾ ਮਿਹਨਤ ਕਰਦੇ ਆ ਸੰਘਰਸ਼ ਕਰਦੇ ਆ ਸੰਘਰਸ਼ ਕਰਕੇ ਆਪਣੇ ਜਿਹੜੀ ਇੱਕ ਸਫ਼ਲਤਾ ਪ੍ਰਾਪਤ ਕਰਦੇ ਆ ਨੌਕਰੀਆਂ ਪ੍ਰਾਪਤ ਕਰਦੇ ਨੇ ਬਹੁਤ ਅਹੁਦਿਆਂ 'ਤੇ ਲੱਗੇ ਹੋਏ ਨੇ ਪਰ ਅ ਜਿਹੜੀ ਹੁਣ ਨੌਜਵਾਨ ਜਿਵੇਂ ਨਸ਼ਿਆਂ ਦੇ ਨਾਲ ਜੂਝ ਰਹੇ ਨੇ ਜਾਂ ਜਿੰਨੇ ਵੀ ਲੱਗ ਰਹੇ ਨੇ ਸਾਨੂੰ ਉਹਨਾਂ ਲਈ ਇਹ ਚਾਹੀਦਾ ਕਿ ਅਸੀਂ ਉਹਨਾਂ ਨੂੰ ਜਾਗਰੂਕ ਕਰਕੇ ਉਹਨਾਂ ਨੂੰ ਉਹਨਾਂ ਦੀ ਜਿਹੜੀ ਕੌਂਸਲਿੰਗ ਕਰਕੇ ਉਹ ਕਿਉਂ ਕਰ ਰਹੇ ਨੇ ਉਹਨਾਂ ਦਾ ਇਸ ਦਾ ਕਾਰਨ ਕੀ ਆ ਤਾਂ ਉਹਨਾਂ ਨੂੰ ਚੰਗੇ ਸੁਝਾਵਾਂ ਦੇ ਨਾਲ ਉਹਨਾਂ ਨੂੰ ਚੰਗੇ ਸੁਝਾਅ ਦੇ ਕੇ ਉਹਨਾਂ ਨੂੰ ਆਪਣੇ ਭਵਿੱਖ ਬਾਰੇ ਜਾਗਰੂਕ ਕਰਕੇ ਅਤੇ ਉਹਨਾਂ ਨੂੰ ਉਹਨਾਂ ਤੋਂ ਸੁਚੇਤ ਕਰਕੇ ਉਹਨਾਂ ਤੋਂ ਅਸੀਂ ਨਸ਼ਿਆਂ ਤੋਂ ਬਚਾ ਸਕਦੇ ਹਾਂ ਧੰਨਵਾਦ